ਮੇਰਾ ਇੱਕ ਦੋਸਤ ਸੀ ਪਰਮਿੰਦਰ ਸਿੰਘ ਜੋ ਕਿ ਮੇਰੇ ਨਜ ਨਜ਼ਦੀਕੀ ਪਿੰਡ ਤੋਂ ਸੀ ਜੇਠ ਦਾ ਮਹੀਨਾ ਸੀ ਮੈਂ ਉਸਨੂੰ ਫੋਨ ਕੀਤਾ ਅਤੇ ਮੈਂ ਉਸਨੂੰ ਕਿਹਾ ਵੀ ਮੇਰੇ ਕੋਲ ਏ ਸੀ ਲੈਣ ਲਈ ਜ਼ਿਆਦਾ ਪੈਸੇ ਨਹੀਂ ਹੈ ਤੂੰ ਮੈਨੂੰ ਇੱਕ ਸੈਕਿੰਡ ਹੈਂਡ ਕੂਲਰ ਦਵਾ ਦੇ ਦੋ ਤਿੰਨ ਦਿਨ ਫੋਨ ਕਰਦਾ ਰਿਹਾ ਚਲੋ ਫਿਰ ਉਹਨੇ ਦੋ ਤਿੰਨ ਦਿਨਾਂ ਤੋਂ ਬਾਅਦ ਮੈਨੂੰ ਇੱਕ ਸੈਂਕਿੰਡ ਹੈਂਡ ਕੂਲਰ ਦਿਖਾਇਆ ਜੋ ਕਿ ਉੱਪਰ ਤੋਂ ਦੇਖਣ ਬਹੁਤ ਠੀਕ ਲੱਗ ਰਿਹਾ ਸੀ ਚਲੋ ਜਦੋਂ ਮੈਂ ਅੱਠ ਹਜ਼ਾਰ ਰੁਪਏ ਦਾ ਸੈਕਿੰਡ ਹੈਂਡ ਕੂਲਰ ਲੈ ਲਿਆ ਉਸ ਤੋਂ ਬਾਅਦ ਪੇਮੈਂਟ ਕਰਤੀ ਸਾਰੀ ਉਹਨਾਂ ਦੀ ਜਦੋਂ ਮੈਂ ਕੂਲਰ ਨੂੰ ਘਰ ਲਿਆਇਆ ਅਤੇ ਚਲਾ ਕੇ ਦੇਖਿਆ ਤਾਂ ਉਹ ਦੋ ਤਿੰਨ ਦਿਨ ਚੱਲਿਆ ਉਸ ਤੋਂ ਬਾਅਦ ਉਸਦੀ ਮੋਟਰ ਖਰਾਬ ਹੋ ਗਈ ਮੋਟਰ ਖਰਾਬ ਹੋਣ ਤੋਂ ਬਾਅਦ ਜਦੋਂ ਮੈਂ ਉਹਦਾ ਪੰਪ ਪਾਣੀ ਵਾਲਾ ਪੰਪ ਚਲਾਇਆ ਉਹ ਵੀ ਨਹੀਂ ਚੱਲਿਆ ਬਹੁਤ ਹੀ ਫਿਰ ਮੈਂ ਫਿਰ ਫੋਨ ਕੀਤਾ ਪਰਮਿੰਦਰ ਨੂੰ ਵੀ ਐਵੇਂ ਹੋ ਗਿਆ ਜਮ੍ਹਾਂ ਹੀ ਬੇਕਾਰ ਨਿਕਲਿਆ ਇਹ ਕੂਲਰ ਇਸ ਕਰਕੇ ਕੋਈ ਵੀ ਚੀਜ਼ ਸੈਕਿੰਡ ਹੈਂਡ ਲੈਣੀ ਹੈ ਤਾਂ ਦੇਖ ਕੇ ਲੈਣੀ ਚਾਹੀਦੀ ਹੈ ਐਵੇਂ ਕੋਈ ਫਾਇਦਾ ਨਹੀਂ ਹੈਗਾ ਲੈ ਕੇ ਉਸ ਤੋਂ ਬਾਅਦ ਮੈਨੂੰ ਘਰਦਿਆਂ ਨੇ ਵੀ ਬੋਲਿਆ ਕਿ ਤੂੰ ਆਹ ਨਵਾਂ ਹੀ ਲੈ ਲੈਂਦਾ ਏ ਸੀ ਜੀ ਕੂਲਰ ਕਰਕੇ ਇਸ ਕਰਕੇ ਫਿਰ ਉਸ ਤੋਂ ਬਾਅਦ ਉਹਦੀ ਜਾਲੀਆਂ ਜਿਹੜੀਆਂ ਉਹ ਵੀ ਖਰਾਬ ਹੋਗੀਆਂ ਫਿਰ ਮੈਂ ਦੁਕਾਨ 'ਤੇ ਲੈ ਕੇ ਗਿਆ ਦੁਕਾਨ ਵਾਲਿਆਂ ਨੂੰ ਪੁੱਛਿਆ ਵੀ ਹਾਂ ਕਿੰਨਾਂ ਖਰਚਾ ਆ ਜਾਵੇਗਾ ਤਾਂ ਉਸਨੇ ਬੋਲਿਆ ਕਿ ਹਾਂ ਸੱਤ ਸੌ ਰੁਪਇਆ ਇਹਦੀ ਮੋਟਰ ਬੰਨਣੇ ਨੂੰ ਲੱਗਣਾ ਏ ਅਤੇ ਫਿਰ ਡੇਢ ਸੌ ਰੁਪਏ ਦੀ ਇਹਦੀ ਪਾਣੀ ਵਾਲੀ ਮੋਟਰ ਆਉਣੀ ਹੈ ਅਤੇ ਮੈਨੂੰ ਗਰਮੀ ਬਹੁਤ ਸੀ ਇਸ ਕਰਕੇ ਫਿਰ ਮੈਨੂੰ ਦੁਬਾਰਾ ਮੋਟਰ ਬਣਾਉਣੀ ਪਈ ਕੂਲਰ ਦੀ